ਹਾਲ ਹੀ ਦੇ ਸਾਲਾਂ ਵਿੱਚ ਭਾਰਤੀ ਅਰਥਚਾਰੇ ਦਾ ਬਹੁਤ ਵਿਕਾਸ ਹੋਇਆ ਹੈ ਜਿਵੇਂ ਕਿ ਸਟੱਡੀ ਬਾਰੇ ਗੱਲ ਕਰੀਏ ਸਮਾਰਟ ਵਰਕ ਹੋਣ ਲੱਗ ਗਿਆ ਹੈ ਸਕੂਲਾਂ ਵਿੱਚ ਬੱਚਿਆਂ ਨੂੰ ਪ੍ਰੋਜੈਕਟ ਰਾਹੀਂ ਸਟੱਡੀ ਕਰਵਾਈ ਜਾਂਦੀ ਹੈ ਜੋ ਬਹੁਤ ਵਧੀਆ ਤਰੀਕਾ ਹੈ ਇੰਡੀਆ ਵਿੱਚ ਰੋਡ ਬਹੁਤ ਵਧੀਆ ਤਰੀਕੇ ਨਾਲ ਬਣਾਏ ਜਾ ਰਹੇ ਹਨ ਰੋਡਾਂ 'ਤੇ ਬਹੁਤ ਸਫਾਈ ਹੁੰਦੀ ਹੈ ਲੋਕ ਸਮਾਰਟ ਵਰਕ ਕਰਦੇ ਹਨ ਜਿਸ ਵਿੱਚੋਂ ਉਹ ਇੰਟਰਨੈਟ ਦੀ ਵਰਤੋਂ ਕਰਦੇ ਹਨ ਅਤੇ ਘਰ ਬੈਠੇ ਹੀ ਪੈਸੇ ਦਾ ਲੈਣ ਦੇਣ ਕਰਦੇ ਹਨ ਉਹਨਾਂ ਨੂੰ ਬੈਂਕਾਂ ਵਿੱਚ ਨਹੀਂ ਜਾਣਾ ਪੈਂਦਾ ਲਾਈਨਾਂ ਵਿੱਚ ਨਹੀਂ ਲੱਗਣਾ ਪੈਂਦਾ ਘਰ ਬੈਠੇ ਹੀ ਪੈਸੇ ਦਾ ਲੈਣ ਦੇਣ ਕਰ ਲੈਂਦੇ ਹਨ ਇੰਡੀਆ ਵਿੱਚ ਕਈ ਐਪ ਲੋਂਚ ਹੋਏ ਹਨ ਜਿਵੇਂ ਜਿਨ੍ਹਾਂ ਨੇ ਲੋਕਾਂ ਦਾ ਸਮਾਂ ਬਚਾਇਆ ਹੈ ਜਿਵੇਂ ਕਿ ਗੂਗਲ ਪੇ ਫੋਨਪੇ ਪੇਟੀਐੱਮ ਇਹ ਐਪ ਰਾਹੀਂ ਲੋਕ ਦੋ ਤਿੰਨ ਸਕਿੰਟ ਵਿੱਚ ਹੀ ਪੈਸੇ ਦੇ ਟ੍ਰਾਂਸਫਰ ਕਰ ਸਕਦੇ ਹਨ ਅਤੇ ਇਸ ਐਪ ਵਿੱਚ ਬਹੁਤ ਸਿਕਿਉਰਿਟੀ ਹੈ ਇਹਨਾਂ ਦਾ ਕੋਈ ਦੂਸਰਾ ਬੰਦਾ ਮਿਸਯੂਜ ਨਹੀਂ ਕਰ ਸਕਦਾ ਇਸ ਕਾਰਨ ਭਾਰਤ ਦਾ ਬਹੁਤ ਵਧੀਆ ਵਿਕਾਸ ਹੋਇਆ ਹੈ ਅਤੇ ਬੱਚਿਆਂ ਨੂੰ ਸਮਾਰਟ ਵਰਕ ਰਾਹੀਂ ਪੜ੍ਹਾਇਆ ਜਾਂਦਾ ਹੈ ਜੋ ਬਹੁਤ ਵਧੀਆ ਤਰੀਕੇ ਨਾਲ ਪੜ੍ਹਦੇ ਹਨ ਪ੍ਰੋਜੈਕਟਾਂ 'ਤੇ ਦੇਖ ਕੇ ਉਹ ਬਹੁਤ ਵਧੀਆ ਸਿੱਖਦੇ ਹਨ ਅਤੇ ਸਟੱਡੀ ਵਿੱਚ ਬਹੁਤ ਵਧੀਆ ਨੰਬਰ ਪ੍ਰਾਪਤ ਕਰਦੇ ਹਨ